ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਰਹਿਣ ਲਈ ਛੋਟੇ ਅਤੇ ਵੱਡੇ ਘਰਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹੋਈਆਂ ਹਨ ਇਹ ਜ਼ਿਲ੍ਹੇ ਦੀ ਆਰਥਿਕ ਵਿਵਸਥਾ ਨੂੰ ਪ੍ਰਭਾਵਿਤ ਕਰਦੇ ਹਨ ਮੋਹਾਲੀ ਜ਼ਿਲ੍ਹਾ ਆਰਥਿਕ ਅਤੇ ਵਿੱਦਿਅਕ ਤੌਰ 'ਤੇ ਇੱਕ ਵਿਕਸਿਤ ਜ਼ਿਲ੍ਹਾ ਹੈ ਇੱਥੇ ਬਾਹਰੋਂ ਆ ਕੇ ਲੋਕਾਂ ਨੇ ਜ਼ਮੀਨਾਂ ਖਰੀਦੀਆਂ ਅਤੇ ਰਹਿਣ ਲਈ ਫਲੈਟ ਅਤੇ ਮਕਾਨ ਬਣਾਏ ਕਿਉਂਕਿ ਇਸ ਕਿੱਤੇ ਵਿੱਚ ਬਹੁਤ ਜ਼ਿਆਦਾ ਪੈਸਾ ਅਤੇ ਰੁਜ਼ਗਾਰ ਦੇ ਸਾਧਨ ਹਨ ਜਿਸ ਨੂੰ ਮੋਹਾਲੀ ਜ਼ਿਲ੍ਹੇ ਦੀ ਆਰਥਿਕਤਾ ਨੂੰ ਸਥਿਰ ਬਣਾਇਆ ਹੈ ਛੋਟੇ ਘਰਾਂ ਦਾ ਕਿਰਾਇਆ ਇਲਾਕੇ ਦੇ ਹਿਸਾਬ ਨਾਲ਼ ਹੈ ਸਿਸ ਸਿੱਖਿਅਕ ਸੰਸਥਾਵਾਂ ਵਿੱਚ ਲੋਕ ਪੜ੍ਹਨ ਬਾਹਰੋਂ ਵੀ ਆਉਂਦੇ ਹਨ ਉਹਨਾਂ ਦੇ ਰਹਿਣ ਲਈ ਕੋਲਜਾਂ ਵਿੱਚ ਹੋਸਟਲ ਹਨ ਅਤੇ ਬਾਹਰ ਵੀ ਰਹਿਣ ਲਈ ਸਸਤੇ ਅਤੇ ਵਧੀਆ ਵਿਕਲਪ ਮੌਜੂਦ ਹਨ